ਯੋਗਾ ਇੱਕ ਪ੍ਰਾਚੀਨ ਅਭਿਆਸ ਹੈ ਜੋ ਸਰੀਰ ਅਤੇ ਮਨ ਦੋਵਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਇਹ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆ ਨਾਲ ਦੂਰ ਕਰਨ ਵਿੱਚ ਮਦਦ ਕਰਦਾ ਯੋਗਾ ਦੇ ਕੁਝ ਫਾਇਦੇ ਇਹ ਹਨ ਤਨਾਵ ਘਟਾਨਾ ਮਨ ਨੂੰ ਸ਼ਾਂਤ ਤੇ ਤਨਾਵ ਨੂੰ ਘਟਾਉਣ ਵਿੱਚ ਮਦਦ ਕਰਦਾ ਮੂਡ ਬਿਹਤਰ ਕਰਨਾ ਯੋਗਾ ਦਿਮਾਗ ਵਿਚ ਖੁਸੀ ਦੇ ਹਾਰਮੋਨਸ ਵੀ ਛਡਦਾ ਹੈ ਜਿਸ ਨਾਲ ਮੂਡ ਬਿਹਤਰ ਹੁੰਦਾ ਹੈ ਨੀਂਦ ਦੀ ਗੁਣਵਤਾ ਵਿਚ ਸੁਧਾਰ ਯੋਗਾ ਨੀਂਦ ਦੀ ਗੁਣਵਤਾ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ ਮੋਟਾਪਾ ਘਟਾਉਣਾ ਯੋਗਾ ਕੈਲਰੀਜ ਬਰਨ ਕਰਨ ਵਿਚ ਤੇ ਮੋਟਾਪਾ ਕਰਾਉਣ ਵਿੱਚ ਮਦਦ ਕਰਦਾ ਦਿਲ ਦੀ ਸੇਹਤ ਲਈ ਫਾਇਦੇਮੰਦ ਯੋਗਾ ਦਿਲ ਨੂੰ ਬਹੁਤ ਮਜਬੂਤ ਬਣਾਉਣ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਲਚਕਤਾ ਵਧਾਉਣਾ ਜੋਗਾ ਸ਼ਰੀਰ ਦੀ ਲਚਕਤਾਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ ਮਾਸ ਪੇਸੀਆਂ ਨੂੰ ਮਜਬੂਤ ਬਣਾਉਣਾ ਯੋਗਾ ਸਰੀਰ ਦੀਆਂ ਮਾਸ ਪੇਸੀਆਂ ਨੂੰ ਮਜਬੂਤ ਬਣਾਉਣ ਵਿੱਚ ਮਦਦ ਕਰਦਾ ਯੋਗਾ ਤੇ ਖਾਸ ਅਭਿਆਸ ਯੋਗਾ ਵਿੱਚ ਕਈ ਤਰ੍ਹਾਂ ਦੀ ਅਭਿਆਸ ਹੁੰਦੇ ਨੇ ਇਹ ਅਭਿਆਸ ਵਿਅਕਤੀ ਦੀ ਉਮਰ ਸਿਹਤ ਅਤੇ ਯੋਗਤਾ ਅਨੁਸਾਰ ਕੀਤੇ ਜਾ ਸਕਦੇ ਕੁਝ ਆਮ ਅਭਿਆਸ ਯੋਗਾ ਵਿੱਚ ਕਈ ਤਰ੍ਹਾਂ ਦੇ ਆਸ਼ਨ ਹੁੰਦੇ ਆ ਜੋ ਸਰੀਰ ਨੂੰ ਮਜਬੂਤ ਬਣਾਉਣਾ ਤੇ ਮਾਸ਼ ਪੇਸੀਆਂ ਨੂੰ ਬਣਾਉਣ ਪ੍ਰਣਾਯਮ ਪ੍ਰਣਾਯਮ ਸਾਹ ਲੈਣ ਦੀਆਂ ਕਾਸਤਰਾਂ ਹਨ ਜੋ ਨੂੰ ਸ਼ਾਂਤ ਕਰਨ ਤੇ ਤਨਾਵ ਘਟਾਉਣ ਵਿਚ ਮਦਦ ਕਰਦੀਆਂ ਹਨ ਧਿਆਨ ਮਨ ਇੱਕ ਬਿੰਦੂ ਦੇ ਨਾਲ ਜੋ ਤਨਾਵ ਨੂੰ ਘਟਾਉਣ ਤੇ ਮਨ ਨੂੰ ਸ਼ਾਂਤ ਕਰਨ ਵਿਚ ਮਦਦ ਕਰਦੀਆਂ ਹਨ ਜੇਕਰ ਤੁਸੀਂ ਯੋਗਾ ਸੁਰੂ ਕਰਨਾ ਚਾਹੁੰਦੇ ਹੋ ਤਾ ਇਕ ਯੋਗਾ ਟੀਚਰ ਦੀ ਸਲਾਹ ਲੈਣੀ ਚਾਹੀਦੀ ਹੈ ਜੋ ਤੁਹਾਨੂੰ ਸਹੀ ਤਰੀਕੇ ਨਾਲ ਅਭਿਆਸ ਕਰਨਾ ਸਿਖਾ ਸਕਦਾ ਯੋਗਾ ਕਰਨਾ ਸਹਿਤ ਦੇ ਲਈ ਬਹੁਤ ਹੀ ਜਰੂਰੀ ਹੈ ਜੋ ਵੀ ਇਹਦੇ ਨਾਲ ਯੋਗਾ ਕਰਨ ਦੇ ਨਾਲ ਸਾਨੂੰ ਬਹੁਤ ਫਾਇਦੇ ਹੁੰਦੇ ਹਨ ਜਿਵੇ ਮਾਸ ਪੇਸੀਆਂ ਦੀ ਮਜਬੂਤੀ ਲਚਕ ਦਾ ਵਧਣਾ ਅਤੇ ਟੈਨਸ਼ਨ ਮੁਕਤ ਟੈਨਸ਼ਨ ਹੋਣ ਟੈਨਸ਼ਨ ਨੂੰ ਦੂਰ ਕਰਨਾ